ਜਿਵੇਂ ਕਿ ਮੈਨੂੰ ਚਿੱਤਰਕਾਰੀ ਕਰਨ ਦਾ ਸ਼ੌਕ ਸ਼ੁਰੂ ਤੋਂ ਰਿਹਾ ਹੈ ਮੈਂ ਕਦੀ ਕਦੀ ਸੋਚਦੀ ਹਾਂ ਕਿ ਮੇਰਾ ਪੈਸ਼ਨ ਔਰ ਮੈਨੂੰ ਅੱਗੇ ਇਹਨੂੰ ਹੀ ਪਰਸੀਊ ਕਰਨਾ ਚਾਹੀਦਾ ਆਪਣੀ ਲਾਈਫ ਵਿੱਚ ਸੋ ਓਬੀਅਸੀਲੀ ਕਿਸੇ ਵੀ ਤਰ੍ਹਾਂ ਦੀ ਪੇਂਟਿੰਗ ਹੋਊਗੀ ਮੈਨੂੰ ਉਹਦੇ 'ਚ ਕਾਫੀ ਜ਼ਿਆਦਾ ਦਿਲਚਸਪੀ ਹੈ ਚਾਹੇ ਉਹ ਇੰਨਡੋਰ ਹੋਵੇ ਜਾਂ ਆਊਟਡੋਰ ਹੋਵੇ ਚਾਹੇ ਸਕੂਲ 'ਚ ਕੋਈ ਨੋਰਮਲ ਡਰਾਇੰਗ ਹੋਵੇ ਜਾਂ ਕੋਈ ਕੋਂਪਟੀਸ਼ਨ ਹੋਵੇ ਪੇਂਟਿੰਗ ਦਾ ਹਰ ਚੀਜ਼ 'ਚ ਮੇਰਾ ਕਾਫੀ ਜ਼ਿਆਦਾ ਇੰਟਰਸਟ ਹੈਗਾ ਵਾ ਹਾਂ ਜਿੱਦਾਂ ਕਿ ਲਾਈਵਫ ਪੇਂਟਿੰਗ ਆ ਅਤੇ ਹਾਂ ਉਹਦੇ 'ਚ ਮੈਂ ਦਿਲਚਸਪੀ ਸ਼ੁਰੂ ਤੋਂ ਰੱਖਦੀ ਹਾਂ ਕਾਫੀ ਜ਼ਿਆਦਾ ਇੱਕ ਟਾਈਮ ਮੇਰੇ ਸਕੂਲ ਵਿੱਚ ਲਾਈਵ ਪੇਂਟਿੰਗ ਹੋਈ ਵੀ ਸੀਗੀ ਕਿ ਸਾਹਮ ਸਾਡੇ ਸਾਹਮਣੇ ਇੱਦਾਂ ਕਰਕੇ ਇੱਕ ਪਰਦਾ ਸੀਗਾ ਉੱਥੇ ਇੱਕ ਜਾਰ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਫਿਸ਼ ਸੀਗੀ ਔਰ ਹਾਂ ਓਵੀਅਸਿਲੀ ਉਹ ਲਾਈਵ ਹੀ ਅਤੇ ਫਿਸ਼ ਜਿੱਦਾਂ ਉਹ ਘੁੰਮਦੀ ਪਈ ਆ ਉਹਦੇ ਵਿੱਚ ਅਤੇ ਉਹ ਫਿਰ ਪਾਣੀ ਵੀ ਹਿੱਲੇਗਾ ਚੀਜ਼ਾਂ ਹਿੱਲਣਗੀਆਂ ਥੋੜ੍ਹੀਆਂ ਥੋੜ੍ਹੀਆਂ ਅਤੇ ਉਹ ਫਿਰ ਮੈਮ ਨੇ ਸਾਨੂੰ ਉਹਦੇ ਸਾਹਮਣੇ ਬਿਠਾਇਆ ਸਾਰੇ ਬੱਚਿਆਂ ਨੂੰ ਔਰ ਕਿਹਾ ਕਿ ਕਰੋ ਪੇਂਟ ਉਹ ਜਿਹੜੀ ਪੇਂਟਿੰਗ ਹੈਗੀ ਉਹ ਮੇਰੀ ਬਹੁਤ ਹੀ ਸੋਹਣੀ ਬਣੀ ਮਤਲਬ ਮੈਨੂੰ ਉਹਦੇ ਵਿੱਚ ਫਸਟ ਪ੍ਰਾਈਜ਼ ਮਿਲਿਆ ਹੈਗਾ ਕਿਉਂਕਿ ਉਹ ਇੱਕ ਚੀਜ਼ ਹੈ ਨਾ ਕਿ ਪੇਂਟਿੰਗ ਆ ਜਿਹੜੀ ਤੁਹਾਡੀ ਉਹ 'ਚ ਦਿਖਣਾ ਵੀ ਚਾਹੀਦਾ ਇਮੋਸ਼ਨਸ ਕਿ ਉਹ ਚੀਜ਼ ਕੀ ਆ ਕਿ ਇਹ ਨਹੀਂ ਕਿ ਬਸ ਬਣਾਉਣ ਲਈ ਬਣਾਉ ਸੋ ਉਹ ਚੀਜ਼ ਮੈਂ ਬਿਲਕੁਲ ਇਮੋਸ਼ਨਸ ਨਾਲ ਬਣਾਈ ਕਿ ਹਾਂ ਕਿ ਕਿੱਦਾਂ ਇੱਕ ਫਿਸ਼ ਆ ਉਹ ਇੱਕ ਜਾਰ ਵਿੱਚ ਰਹਿੰਦੀ ਆ ਉਹਦੀ ਲਾਈਫ ਉਹ ਸਭ ਕੁਝ ਸੋ ਹਾਂ ਕੁਛ ਲੋਕ ਕਹਿੰਦੇ ਆ ਕਿ ਸ਼ਾਇਦ ਲਾਈਵ ਪੇਟਿੰਗ ਕਰਨਾ ਕਾਫੀ ਮੁਸ਼ਕਲ ਆ ਬਟ ਮੈਨੂੰ ਨਹੀਂ ਲੱਗਦਾ ਮੇਰੇ ਅਕੋਰਡਿੰਗਲੀ ਇਹ ਕਾਫੀ ਸੌਖਾ ਔਰ ਕਾਫੀ ਇੰਟਰਸਟਿੰਗ ਆ ਤੁਸੀਂ ਕੋਈ ਵੀ ਲਾਈਵ ਪੇਟਿੰਗ ਕਰੋਗੇ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਸੋ ਆਫ ਕੋਰਸ ਕਿ ਮੁਸ਼ਕਲ ਨਹੀਂ ਆ ਕਾਫੀ ਇੰਟਰਸਟਿੰਗ ਔਰ ਕਾਫੀ ਸੌਖਾ ਹੈ